ਸਾਡੇ ਖੇਤਰ ਵਿੱਚ ਸਾਰੀਆਂ ਭਾਸ਼ਾਵਾਂ ਦੀਆਂ ਹੀ ਖਬਰਾਂ ਉਪਲਬਧ ਹਨ ਜਿਸ ਤਰਾਂ ਕਿ ਗੱਲ ਕਰੀਏ ਤਾਂ ਟੀ ਵੀ ਵਿੱਚ ਲੇਵਿੰਗ ਇੰਡੀਆ ਜੀ ਪੀ ਟੀ ਸੀ ਪੰਜਾ ਪੀ ਟੀ ਸੀ ਨਿਊਜ਼ ਪੀ ਟੀ ਸੀ ਨਿਊਜ਼ ਜੀ ਨਿਊਜ਼ ਅਤੇ ਇਸ ਚੈਨਲ ਚੜਦੀ ਕਲਾ ਇਸ ਤਰ੍ਹਾਂ ਨਿਊਜ਼ ਚੈਨਲ ਨੇ ਜਿਨਾਂ 'ਤੇ ਸਾਰੀਆਂ ਹੀ ਖਬਰਾਂ ਹੁੰਦੀਆਂ ਹਨ ਇਸ ਤੋਂ ਇਸ ਤੋਂ ਇਲਾਵਾ ਜੇ ਅਖਬਾਰ ਦੀ ਗੱਲ ਕਰੀਏ ਤਾਂ ਅਖਬਾਰ ਵਿੱਚ ਦੈਨਿਕ ਜਾਗਰਨ ਅਜੀਤ ਜਗਬਾਣੀ ਜਗਬਾਣੀ ਇਹ ਖਬਰਾਂ ਹਨ ਤੇ ਇਸ ਵਿੱਚ ਜ਼ਿਆਦਾ ਪੰਜਾਬੀ ਪੰਜਾਬੀ ਹਿੰਦੀ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਸਾਰੇ ਤਰ੍ਹਾਂ ਦੀਆਂ ਹੀ ਇੰਨੇ ਸਾਰੇ ਤਰ੍ਹਾਂ ਦੀਆਂ ਹੀ ਚੈਨਲ ਨਿਊਜ਼ ਅਖਬਾਰਾਂ ਪਾਈਆਂ ਜਾਂਦੀਆਂ ਸਨ ਸਾਨੂੰ ਵੱਧ ਤੋਂ ਵੱਧ ਸਾਨੂੰ ਵੱਧ ਤੋਂ ਵੱਧ ਨਿੂਊਜ਼ ਦੇਖਣੀਆਂ ਚਾਹੀਦੀਆਂ ਹਨ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਦੁਨੀਆ 'ਤੇ ਕੀ ਚੱਲ ਰਿਹਾ ਹੈ